ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਕਾਨੂੰਨੀ ਦਸਤਾਵੇਜ ਬਣਉਣ ਦਾ ਮੇਰਾ ਅਨੁਭਵ ਬਹੁਤ ਹੀ ਵਧੀਆ ਹੈ ਮੈਂ ਆਪਣੇ ਬਹੁਤ ਹੀ ਜ਼ਿਆਦਾ ਦਸਤਾਵੇਜ ਬਣਾਏ ਹਨ ਜਿਵੇਂ ਕਿ ਪਾਸਪੋਰਟ ਪੈਨ ਕਾਰਡ ਆਧਾਰ ਕਾਰਡ ਅਤੇ ਆਪਣੇ ਘਰ ਦੇ ਕਾਨੂੰਨੀ ਦਸਤਾਵੇਜ ਇਸ ਇਹ ਦਸਤਾਵੇਜ ਬਣਉਣੇ ਮੁਸ਼ਕਲ ਹਨ ਕਿਉਂਕਿ ਇਹਨਾਂ ਵਿੱਚ ਇਹਨਾਂ ਦੇ ਬਣਾਉਣ ਲਈ ਆਪਾਂ ਨੂੰ ਆਪਣੇ ਸਾਰੇ ਪਰੂਫ ਦੇਣੇ ਪੈਂਦੇ ਹਨ ਆਪਣੇ ਸਾਰੇ ਪਰਿਵਾਰ ਦੇ ਦਸਤਖਤ ਕਰਨੇ ਪੈਂਦੇ ਹਨ ਆਪਣੇ ਮਾਤਾ ਪਿਤਾ ਦੇ ਆਪਣੇ ਮਾਤਾ ਪਿਤਾ ਦੇ ਫੋਟੋ ਆਪਣੀ ਫੋਟੋ ਆਪਣੇ ਦਸਤ ਦਸਤਖਤ ਅਤੇ ਬਹੁਤ ਹੀ ਸਾਰੇ ਦਸਤਾਵੇਜ ਲਗਾਉਣੇ ਪੈਂਦੇ ਹਨ ਤਾਂ ਆਪਾਂ ਨੂੰ ਇੱਕ ਦਸਤਾਵੇਜ ਪ੍ਰਾਪਤ ਹੁੰਦਾ ਹੈ ਬਹੁਤ ਹੀ ਪਰੂਫ ਲਗਾਉਣ ਵਜੋਂ ਆਪਾਂ ਨੂੰ ਆਪਾਂ ਨੂੰ ਬਹੁਤ ਹੀ ਸਾਰੀ ਸੰਸਥਾਵਾਂ ਸਰਕਾਰੀ ਸੰਸਥਾਵਾਂ ਵਿੱਚ ਜਾਣਾ ਪੈਂਦਾ ਹੈ ਜਿੱਥੇ ਹਰ ਇੱਕ ਦਸਤਾਵੇਜ ਸਬਮਿਟ ਕਰਨਾ ਪੈਂਦਾ ਹੈ ਕੁਝ ਦਸਤਾਵੇਜ ਜਿਵੇਂ ਕਿ ਪਾਸਪੋਰਟ ਅਤੇ ਆਪਣੇ ਘਰ ਦੇ ਦਸਤਾਵੇਜ ਪ੍ਰਾਪਤ ਕਰਨੇ ਬਹੁਤ ਜ਼ਿਆਦਾ ਔਖੇ ਹਨ ਪਾਸਪੋਰਟ ਪਾਸਪੋਰਟ ਵਾਲਾ ਦਸਤਾਵੇਜ ਪ੍ਰਾਪਤ ਕਰਨ ਲਈ ਆਪਾਂ ਨੂੰ ਪਹਿਲਾਂ ਫੋਨ ਤੋਂ ਅਪਲਾਈ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਆਪਾਂ ਨੂੰ ਚੰਡੀਗੜ੍ਹ ਜਾ ਕੇ ਆਪਣੀ ਫੈਮਲੀ ਦਾ ਪਰੂਫ ਆਪਣੀ ਫੋਟੋ ਅਤੇ ਕਾਫੀ ਸਾਰਾ ਕੰਮ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਆਪਣੇ ਘਰ ਜਿੱਥੇ ਆਪਾਂ ਰਹਿੰਦੇ ਹਾਂ ਉੱਥੇ ਇੰਨਕੁਆਇਰੀ ਲਈ ਪੁਲਿਸ ਅਫਸਰ ਆਉਂਦਾ ਹੈ ਇਸ ਤਰ੍ਹਾਂ ਮੈਂ ਕਾਫੀ ਸਾਰੇ ਦਸਤਾਵੇਜ ਬਣਾਏ ਹਨ ਅਤੇ ਮੇਰਾ ਅਤੇ ਮੇਰਾ ਅਨੁਭਵ ਠੀਕ ਠੀਕ ਹੀ ਰਿਹਾ ਹੈ ਧੰਨਵਾਦ